ਹੈਲੋ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਜੇ ਬਸ ਠੀਕ ਠਾਕ ਵਧੀਆ ਹੋ ਗਈ ਸੈਟਿੰਗ ਘਰ ਦੀ

ਹਾਂ ਉਹ ਤਾਂ ਹੈ ਨਾਲੋਂ ਨਾਲ ਹੀ ਹੁੰਦੇ ਫਿਰ ਘਰ ਦਾ ਫੈਮਲੀ

ਵੈਸੇ ਤਾਂ ਮਤਲਬ ਜੋ ਹੈ ਮੇਨ ਬਾਜ਼ਾਰ ਜਿਹੜਾ ਹੋਲ ਬਜ਼ਾਰ ਹੈ ਹੋਲ ਗੇਟ ਸਾਈਡ 'ਤੇ ਮੇਨ ਕਾਫੀ ਮਾਰਕੀਟ ਵਿੱਚ ਵਧੀਆ ਚੀਜ਼ਾਂ ਵੀ ਅਵੇਲੇਬਲ ਨੇ ਅਤੇ ਇਸ ਤੋਂ ਬਿਨਾਂ ਆਪਣੇ ਅੰਦਰ ਪੁਤਲੀਗੜ੍ਹ ਸਾਈਡ 'ਤੇ ਜਾਂ ਪਿੰਕ ਪਲਾਜ਼ਾ ਅਤੇ ਇਸ ਤੋਂ ਬਿਨਾਂ ਸਾਡੇ ਮੋਲ ਵੀ ਹੁਣ ਕਾਫੀ ਬਣੇ ਹੋਏ ਆ ਅਤੇ ਉੱਥੇ ਫਿਰ ਨਵੀਂ ਨਵੀਂ ਵਰਾਇਟੀ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਮਿਲਦੀਆਂ ਨੇ ਅਤੇ ਕਿਤੇ ਆਪਾਂ ਨੂੰ ਜਿਹੜਾ ਵੀ ਲੱਗਦਾ ਨੀਅਰ ਬਾਏ ਆਪਾਂ ਉੱਥੋਂ ਲੈ ਸਕਦੇ ਹਾਂਜੀ ਹਾਂਜੀ ਇੱਧਰ ਜੇ ਹੋਲ ਗੇਟ ਵੱਲ ਤਾਂ ਠੀਕ ਆ ਰੇਟ ਵਗੈਰਾ ਹੋਲ ਸੇਲ ਹੀ ਲੱਗਦੀ ਆ ਉਹਨਾਂ ਦੀ ਇਹ ਆ ਵੀ ਨਾਲ ਉਹਦੇ ਨਾਲ ਨਾਲ ਤੁਹਾਨੂੰ ਵਰਾਇਟੀ ਵੀ ਮਿਲ ਜਾਏਗੀ ਨਾ ਨਾਲ

ਚਲੋ ਕੋਈ ਨਹੀਂ ਕੋਈ ਓਕੇ ਜੀ ਓਕੇ ਕਰ ਲਿਓ ਪਹੁੰਚ ਕੇ ਓਕੇ